ਮੈਂ ਹਰ ਇੱਕ ਨੂੰ ਹੱਥ ਨਾਲ ਬਣਾਈ ਹੋਈ ਚੀਜ਼ ਦੇਣਾ ਜ਼ਿਆਦਾ ਪਸੰਦ ਕਰਦੀ ਹਾਂ ਮੈਂ ਇੱਕ ਇੱਕ ਵਾਰੀ ਇੱਕ ਕਾਰਡ ਆਪਣੇ ਹੱਥੀਂ ਕਾਫੀ ਵੱਡਾ ਅਤੇ ਕਾਫੀ ਰੀਝ ਨਾਲ ਬਣਾਇਆ ਸੀ ਜਿਹੜਾ ਮੈਂ ਕਿਸੇ ਨੂੰ ਬੱਡੇ ਅਤੇ ਗਿਫਟ ਕੀਤਾ ਸੀ ਇਸ ਦਾ ਜ਼ਿਆਦਾ ਭਾਵਨਾਤਮਕ ਮੁੱਲ ਇਸ ਲਈ ਹੁੰਦਾ ਹੈ ਕਿਉਂਕਿ ਅਸੀਂ ਆਹ ਚੀਜ਼ ਆਪਣੇ ਦਿਲ ਤੋਂ ਬਣਾਈ ਹੁੰਦੀ ਹੈ